ਉੱਨੀ ਮਾਰਚ ਉੱਨੀ ਸੌ ਸਤਾਨਵੇਂ ਨੂੰ ਮੇਰਾ ਜਨਮ ਅੱਜ ਦੇ ਦਿਨ ਹੋਇਆ ਸੀ ਅਤੇ ਅੱਜ ਮੈਨੂੰ ਅਤੇ ਮੇਰੀ ਪਰਿਵਾਰ ਨੂੰ ਬਹੁਤ ਖੁਸ਼ੀ ਹੈ ਅਤੇ ਖੁਸ਼ੀਆਂ ਭਰਿਆ ਦਿਨ ਹੈ ਇਸ ਵਿਸ਼ੇਸ਼ ਦਿਨ ਹੈ ਮੇਰਾ ਨਾਮ ਰਵਿੰਦਰ ਸਿੰਘ ਹੈ ਅਤੇ ਇਸ ਹੀ ਇਸ ਖੁਸ਼ੀ ਦੇ ਮੌਕੇ 'ਤੇ ਮੈਂ ਅਤੇ ਮੇਰਾ ਪਰਿਵਾਰ ਕੱਪੜਾ ਖਰੀਦਣ ਲਈ ਬਾਜ਼ਾਰ ਗਏ ਬਾਜ਼ਾਰ ਸਾਡੇ ਪਿੰਡ ਹੰਢਿਆਇਆ ਤੋਂ ਤਿੰਨ ਕਿਲੋਮੀਟਰ ਦੂਰ ਬਰਨਾਲਾ ਸ਼ਹਿਰ ਵਿੱਚ ਹੈ ਤਾਂ ਜੋ ਅਸੀਂ ਉਸ 'ਤੇ ਆਟੋ ਰਾਹੀਂ ਪਹੁੰਚ ਸਕੇ ਅਤੇ ਉੱਥੇ ਜਾ ਕੇ ਅਸੀਂ ਕੀ ਦੇਖਿਆ ਉੱਥੇ ਦੁਕਾਨਦਾਰ ਨੇ ਸਾਨੂੰ ਕਈ ਰੰਗਾਂ ਦੇ ਵਿੱਚ ਕੱਪੜੇ ਦਿਖਾਏ ਜਿਸ ਦੇ ਵਿੱਚ ਅਸੀਂ ਆਪਣੇ ਆਪ ਲਈ ਕਨਫਿਊਜ ਹੋ ਗਏ ਵੀ ਕਿਹੜਾ ਰੰਗ ਆਪਣਾ ਮਨ ਪਸੰਦੀ ਕੱਪੜਾ ਲੈ ਸਕੀਏ ਰੰਗਾਂ ਦੇ ਵਿੱਚ ਹਰ ਇੱਕ ਰੰਗ ਸਾਨੂੰ ਮਨ ਪਸੰਦ ਵੀ ਲੱਗੇ ਅਤੇ ਨਾ ਮਨ ਪਸੰਦ ਵੀ ਹੋਇਆ ਬਟ ਉਸ ਦੇ ਵਿੱਚ ਕਈ ਰੰਗ ਸਾਨੂੰ ਪਸੰਦ ਵੀ ਆਏ ਅਤੇ ਕਈਆਂ 'ਤੇ ਸਾਨੂੰ ਨਾ ਪਸੰਦੀ ਵੀ ਹੋਈ ਹੈ ਅਤੇ ਅਸੀਂ ਦੇਖਿਆ ਵੀ ਰੰਗ ਦੀ ਪੜਚੋਲ ਕਿੱਦਾਂ ਕੀਤੀ ਜਾਵੇ ਅਸੀਂ ਹਰ ਇੱਕ ਰੰਗ ਨੂੰ ਰੰਗ ਦੇ ਕੱਪੜੇ ਨੂੰ ਆਪਣੇ ਅੰਗ ਦੇ ਨਾਲ ਲਗਾ ਕੇ ਦੇਖਿਆ ਅਤੇ ਸ਼ੀਸ਼ੇ ਮੂਹਰੇ ਖੜ੍ਹ ਕੇ ਦੇਖਿਆ ਵੀ ਇਹ ਕਲਰ ਕਿੱਦਾਂ ਦਾ ਲੱਗਦਾ ਹੈ ਬਟ ਕਈ ਕਲਰ ਅਸੀਂ ਟਰਾਈ ਕਰੇ ਵਾਰ ਵਾਰ ਟਰਾਈ ਕੀਤੇ ਉਸ 'ਤੇ ਕਈ ਕਲਰਾਂ ਦਾ ਕਲਰ ਰੰਗ ਸਾਨੂੰ ਨਹੀਂ ਪਸੰਦ ਆਇਆ ਕੱਪੜਾ ਬਹੁਤ ਹੀ ਲਾਭਦਾਇਕ ਅਤੇ ਅਲੱਗ ਹੀ ਕਲਰਾਂ ਦਾ ਸੀ ਜੋ ਸਾਨੂੰ ਲਾਸਟ 'ਤੇ ਇੱਕ ਕਲਰ ਪਸੰਦ ਆਇਆ ਉਹ ਹੈ ਆਲਿਵ ਕਲਰ ਦੇ ਵਿੱਚ ਸਾਨੂੰ ਕੱਪੜਾ ਪਸੰਦ ਆਇਆ ਕੱਪੜਾ ਬਹੁਤ ਸੋਹਣਾ ਅਤੇ ਬਹੁਤ ਹੀ ਅੱਛੇ ਸਟਾਫ ਦਾ ਸੀ